ਸਕੂਲ ਵਿੱਚ ਮੇਰਾ ਮਨਪਸੰਦ ਪੰਜਾਬੀ ਰਹਿ ਚੁੱਕਾ ਸੀ ਅਤੇ ਇਸ ਕਰਕੇ ਮੈਨੂੰ ਪੰਜਾਬੀ ਪੜ੍ਹਨੀ ਲਿਖਣੀ ਸੁਣਨੀ ਬਹੁਤ ਜ਼ਿਆਦਾ ਪਸੰਦ ਸੀ ਕਿਉਂਕਿ ਇਸਦੇ ਵਿੱਚ ਸਾਡੇ ਪੰਜਾਬ ਨਾਲ ਸਬੰਧਿਤ ਦੇਸ਼ ਨਾਲ ਸਬੰਧਿਤ ਸਾਡੇ ਕਲਚਰ ਨਾਲ ਸਬੰਧਿਤ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਅਤੇ ਸਾਡੇ ਜੋ ਇਤਿਹਾਸਿਕ ਗੱਲਾਂ ਹਨ ਉਹ ਸਿੱਖਣ ਨੂੰ ਮਿਲੀਆਂ ਅਤੇ ਇਸਦੇ ਵਿੱਚ ਕਹਾਣੀਆਂ ਇਕਾਂਗੀ ਕਵਿਤਾਵਾਂ ਅਜਿਹੀਆਂ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਜਾਂ ਸੁਣਨ ਨੂੰ ਪੜ੍ਹਨ ਨੂੰ ਮਿਲੀਆਂ ਜੋ ਕਿ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਸੀ ਅਤੇ ਇਹਨਾਂ ਜੋ ਗੱਲਾਂ ਹਨ ਇਹਨਾਂ ਗੱਲਾਂ ਨੇ ਬਹੁਤ ਪ੍ਰਭਾਵਿਤ ਕੀਤਾ ਅਤੇ ਅੱਜ ਜੋ ਹੈ ਪੰਜਾਬੀ ਵਿੱਚ ਅਸੀਂ ਮਤਲਬ ਅਸੀਂ ਇੱਕ ਕਹਿ ਸਕਦੇ ਹਾਂ ਕਿ ਅਸੀਂ ਲਿਖ ਵੀ ਸਕਦੇ ਹਾਂ ਪੜ ਵੀ ਸਕਦੇ ਹਾਂ ਇਸ ਕਰਕੇ ਮੈਨੂੰ ਪੰਜਾਬੀ ਜੋ ਹੈ ਮੇਰਾ ਬਹੁਤ ਹੀ ਮਨਪਸੰਦੀ ਦਾ ਵਿਸ਼ਾ ਰਹਿ ਚੁੱਕਾ ਹੈ ਜਿਸ ਦੇ ਕਰਕੇ ਕਿ ਮੈਨੂੰ ਪੰਜਾਬੀ ਵਿੱਚ ਲਿਖਣ ਦਾ ਹੁਨਰ ਵੀ ਪ੍ਰਾਪਤ ਹੋਇਆ ਇਸ ਕਰਕੇ ਪੰਜਾਬੀ ਵਿਸ਼ਾ ਮੇਰਾ ਮਨਪਸੰਦੀ ਦਾ ਵਿਸ਼ਾ ਹੋਇਆ